ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਰ ਜੀ ਜੀਤ ਬੋਲਦਾ ਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਮਾਰਕੀਟ ਦੇ ਵਿੱਚ ਮਿਲ ਜਾਂਦੀ ਹੈ ਜੇ ਇੱਕ ਤਾਂ ਬੱ ਹਾਂਜੀ ਹਾਂਜੀ ਇੱਕ ਤਾਂ ਬੱਸ ਸਟੈਂਡ ਦੇ ਲਾਗੇ ਸਬਜ਼ੀਆਂ ਦੀਆਂ ਰੇੜੀਆਂ ਵਗੈਰਾ ਫ਼ਲਾਂ ਦੀਆਂ ਰੇੜੀਆਂ ਲੱਗਦੀਆਂ ਵਾ ਅਤੇ ਕੁਛ ਇੱਥੇ ਜੀ ਇੱਥੇ ਪੁਰਾਣੀ ਇਹ ਬੱਸ ਸਟੈਂਡ ਸੀਗਾ ਉੱਥੇ ਹੁਣ ਸਬਜ਼ੀ ਦਾ ਕੰਮ ਹੈ ਸਬਜ਼ੀ ਮਤਲਬ ਸਬਜ਼ੀ ਮੰਡੀ ਸਮਝ ਲਓ ਅਤੇ ਸਬਜ਼ੀ ਮੰਡੀ ਦਾ ਕੰਮ ਹੈ ਸਾਰਾ ਰੇੜੀਆਂ ਰੂੜੀਆਂ ਉੱਥੇ ਬਹੁਤ ਲੱਗਦੀਆਂ ਵਾ ਫ਼ਲਾਂ ਦੀਆਂ ਸਬਜ਼ੀਆਂ ਦੀਆਂ ਉਹ ਤੁਸੀਂ ਗੁਰਦਾਸਪੁਰ ਰੇਲਵੇ ਫਾਟਕ ਟੱਪ ਕੇ ਨਾ ਅਗਲੇ ਪਾਸੇ ਉੱਥੇ ਸਬਜ਼ੀ ਮੰਡੀ ਆ ਗੁਰਦਾਸਪੁਰ ਦੀ ਉੱਥੇ ਤੁਸੀਂ ਸਵੇਰੇ ਪੰਜ ਸਾਢੇ ਪੰਜ ਵਜੇ ਜਾ ਕੇ ਤੇ ਆਪਣੀ ਮਤਲਵ ਫਰੈਸ਼ ਸਬਜ਼ੀ ਜਿਮੀਦਾਰਾਂ ਤੋਂ ਸਿੱਧੀ ਇੱਕ ਤਾਂ ਸਸਤੇ ਰੇਟ 'ਤੇ ਮਿਲੂਗੀ ਤੁਹਾਨੂੰ ਅਤੇ ਉਹ ਤੁਹਾਨੂੰ ਜਿੰਨੀ ਵੀ ਚਾਹੀਦੀ ਬਿਲਕੁਲ ਫਰੈਸ਼ ਸਬਜ਼ੀ ਆਉਂਦੀ ਹੈ ਤਾਜ਼ੀ ਹਾਂਜੀ ਨਾਲ ਹੀ ਫਰੂਟ ਦਾ ਕੰਮ ਆ ਫਰੂਟ ਵੀ ਉੱਥੇ ਤੁਹਾਨੂੰ ਸਬਜ਼ੀ ਵੀ ਫਰੈਸ਼ ਬਿਲਕੁਲ ਮਿਲ ਸਕਦੀ ਸਵੇਰ ਟਾਈਮ ਹਾਂਜੀ ਬਿਲਕੁਲ ਬਿਲਕੁਲ ਜੈਨੂਅਨ ਰੇਟ ਉਹ ਤਾਂ ਵੇਚਣ ਵਾਲੇ ਵੀ ਉੱਥੋਂ ਲਿਆ ਕੇ ਅਤੇ ਮੁੜ ਕੇ ਹੀ ਰੇਟ ਵਧਾ ਕੇ ਵੇਚਦੇ ਆ ਹਾਂ ਆਪਣਾ ਮਾਲ ਚੰਗਾ ਉੱਥੇ ਤਾਂ ਤੁਹਾਨੂੰ ਬਿਲਕੁਲ ਮਤਲਬ ਕੰਟਰੋਲ ਰੇਟ 'ਤੇ ਤਾਜ਼ੀ ਬਿਲਕੁਲ ਫਰੈਸ਼ ਹਰ ਇੱਕ ਸਬਜ਼ੀ ਮਿਲੇਗੀ ਹਾਂਜੀ ਨਹੀਂ ਨਹੀਂ ਉਹ ਵਧੀਆ ਸਭ ਤੋਂ ਵਧੀਆ ਮੰਡੀ ਤੇ ਚੱਲ ਜਾਓ ਮੰਡੀ ਦੇ ਵਿੱਚੋਂ ਤਾਜ਼ੀ ਸਬਜ਼ੀ ਲੈ ਕੇ ਆਓ ਇੱਥੇ ਮਿਲੂ ਜੈਨੂਅਨ ਰੇਟ 'ਤੇ ਹਾਂ ਨਾ ਨਾ ਬਿਲਕੁਲ ਫਰੈਸ਼ ਉੱਥੋਂ ਮਿਲੂਗੀ ਤੁਹਾਨੂੰ ਵਧੀਆ 'ਚ ਠੀ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਓ ਓਕੇ ਜੀ ਓਕੇ